ਮੈਂ ਰੋਜ਼ਾਨਾ ਬੱਸ ਵਿੱਚ ਸਫ਼ਰ ਕਰਦੀ ਹਾਂ ਸਭ ਤੋਂ ਪਹਿਲਾਂ ਮੈਂ ਘਰੋਂ ਦੇ ਨੇੜੇ ਬੱਸ ਸਟੈਂਡ ਤੋਂ ਬੱਸ ਪਕੜਦੀ ਹਾਂ ਅਤੇ ਅਤੇ ਬੱਸ ਪਕੜਨ ਤੋਂ ਬਾਅਦ ਮੈਂ ਆਪਣਾ ਬੈਗ ਕੈਰੀਅਰ ਉੱਪਰ ਰੱਖਦੀ ਹਾਂ ਤਾਂ ਜੋ ਹੋਰ ਸਵਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਬੱਸ ਵਿੱਚ ਇੱਕ ਡਰਾਈਵਰ ਸੀਟ ਹੁੰਦੀ ਹੈ ਜਿੱਥੇ ਡਰਾਈਵਰ ਬੈਠ ਕੇ ਬੱਸ ਨੂੰ ਚਲਾਉਂਦਾ ਹੈ ਬੱਸ ਵਿੱਚ ਵਿੰਡੋ ਸੀਟਾਂ ਵੀ ਹੁੰਦੀਆਂ ਹਨ ਜਿਸਦੀ ਜ਼ਰੂਰਤ ਐਮਰਜੈਂਸੀ ਦੇ ਟਾਈਮ ਪੈ ਸਕਦੀ ਹੈ ਤਾਂ ਜੋ ਆਪਾਂ ਉਨ੍ਹਾਂ ਨੂੰ ਇਸਤੇਮਾਲ ਕਰ ਸਕੀਏ ਡੀਜ਼ਲ ਡੀਜ਼ਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਬੱਸ ਨੂੰ ਚੱਲਣ ਵਾਸਤੇ ਜ਼ਰੂਰੀ ਹੈ ਤਾਂ ਕੰਮ ਕਰਦਾ ਹੈ ਅਤੇ ਬੱਸ ਦੁਆਰਾ ਮੈਂ ਰੋਜ਼ਾਨਾ ਹੀ ਸਫ਼ਰ ਕਰਦੀ ਹਾਂ